ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਮੈਂ ਜਗਦੀਸ਼ ਕੁਮਾਰੀ ਗੁਰਦਾਸਪੁਰ ਤੋਂ ਬੋਲ ਰਹੀ ਹਾਂ ਮੈਂ ਤੁਹਾਨੂੰ ਧਾਰਮਿਕ ਸਥਾਨਾਂ ਬਾਰੇ ਦੱਸਣਾ ਚਾਹੁੰਦੀ ਹਾਂ ਅਸੀਂ ਜਦੋਂ ਸਰ ਪਹਿਲੇ ਛੋਟੇ ਹੁੰਦੇ ਸੀ ਉਦੋਂ ਅਸੀਂ ਮਿੱਟੀ ਮਲਦੇ ਸੀ ਉਹਨਾਂ ਨੂੰ ਅਸੀਂ ਕਾਫੀ ਤਰ੍ਹਾਂ ਮਲ ਮਲ ਕੇ ਉਹਨਾਂ ਨੂੰ ਉਹਨਾਂ ਦੀਆਂ ਮੂਰਤੀਆਂ ਬਣਾਉਂਦੇ ਸੀ ਕੰਧ ਨਾਲ ਚਿਪਕਾਉਂਦੇ ਸੀ ਉਹਨਾਂ ਉੱਤੇ ਸਿੱਕੇ ਵੀ ਲਗਾਏ ਜਾਂਦੇ ਸੀ ਉਹਨਾਂ ਨੂੰ ਬਹੁਤ ਵਧੀਆ ਨਾਲ ਸਜਾਵਟ ਕੀਤਾ ਜਾਂਦਾ ਸੀ ਪਹਿਲੇ ਜ਼ਮਾਨੇ 'ਚ ਕਰਦੇ ਸੀ ਹੁਣ ਵੀ ਬੱਚੇ ਕਰਦੇ ਪਰ ਹੁਣ ਉਹ ਕਲਚਰ ਥੋੜ੍ਹਾ ਚੇਂਜ ਹੋ ਗਿਆ ਹੁਣ ਨਹੀਂ ਕਰਦੇ ਹੈਗੇ ਪਹਿਲੇ ਕਰਦੇ ਸੀ ਬਹੁਤ ਸੋਹਣੇ ਤਰੀਕੇ ਨਾਲ ਅਸੀਂ ਉਹਨਾਂ ਨੂੰ ਬਣਾਉਂਦੇ ਸੀ ਮੂਰਤੀਆਂ ਅਤੇ ਉਹਨਾਂ ਨੂੰ ਅਸੀਂ ਤਿਆਰ ਵੀ ਕਰਦੇ ਸੀ ਅਤੇ ਕੁੜੀਆਂ ਇਕੱਠੀਆਂ ਹੁੰਦੀਆਂ ਸੀ ਫਿਰ ਅਸੀਂ ਰਾਤ ਨੂੰ ਅਸੀਂ ਗੀਤ ਵੀ ਗਾਉਂਦੇ ਸੀ ਉੱਥੇ ਨਵਰਾਤਰੇ ਵੀ ਰੱਖਦੇ ਸੀ ਇੱਕ ਮ ਮਾਤਾ ਦੇ ਭੇਟਾਂ ਵੀ ਗਾਉਂਦੇ ਸੀ ਅਤੇ ਅਸੀਂ ਬਹੁਤ ਮਨੋਰੰਜਨ ਵੀ ਕਰਦੇ ਸੀ ਬਹੁਤ ਮਜ਼ਾ ਆਉਂਦਾ ਸੀ ਉਦੋਂ ਛੋਟੇ ਬੱਚੇ ਜਦੋਂ ਸਾਰੇ ਕਰਦੇ ਸੀ ਫਿਰ ਕਦੇ ਮਾਤਾ ਵੀ ਮਗਰ ਕਰਦੇ ਮੰਗਣ ਜਾਂਦੇ ਸੀ ਸਾਰਾ ਕੁਝ ਕਰਦੇ ਸੀ ਉਹ ਲਕ ਕਲਚਰ ਬਹੁਤ ਹੀ ਵਧੀਆ ਸੀ ਸੋ ਬਹੁਤ ਸੋਹਣਾ ਲੱਗਦਾ ਸੀ ਬਹੁਤ ਵਧੀਆ ਲੱਗਦਾ ਸੀ ਉਹ ਟਾਈਮ ਬਹੁਤ ਵਧੀਆ ਸੀ ਹੁਣ ਤਾਂ ਉਹ ਟਾਈਮ ਨਹੀਂ ਹੈਗਾ ਹੁਣ ਬੱਚੇ ਆ ਕੰਮ ਨਹੀਂ ਕਰਦੇ ਹੁਣ ਬੱਚੇ ਮੋਬਾਇਲਾਂ 'ਤੇ ਲੱਗੇ ਰਹਿੰਦੇ ਨੇ ਉਸ ਵੇਲੇ ਇਹ ਕੰਮ ਬਹੁਤ ਵਧੀਆ ਕਰਦੇ ਸੀ ਬੱਚੇ ਸਾਰੀਆਂ ਕੁੜੀਆਂ ਇਕੱਠੀਆਂ ਹੋ ਕੇ ਰਾਤ ਨੂੰ ਬਹੁਤ ਹੀ ਭੇਟਾਂ ਗਾਉਂਦੀਆਂ ਸਨ ਅਤੇ ਬਹੁਤ ਹੀ ਮਨੋਰੰਜਨ ਕਰਦੇ ਸਨ ਠੀਕ